ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਮੈਂ ਜ਼ਿਲ੍ਹਾਂ ਮੋਹਾਲੀ ਪਿੰਡ ਪਲਹੇੜੀ ਤੋਂ ਬੋਲਦੀ ਆ ਜੀ ਮੈਂ ਇੱਕ ਕੰਪਲੇਂਟ ਲਖਵਾਉਣੀ ਸੀ ਜੀ ਮੈਂ ਨਾ ਦੋ ਦਿਨ ਪਹਿਲਾਂ ਰੇਲਵੇ ਸਟੇਸ਼ਨ 'ਤੇ ਗਈ ਸੀ ਮੈਂ ਕਿਸੇ ਕੰਮ ਤੇ ਜਾਣਾ ਸੀ ਟਰੇਨ ਦੁਆਰਾ ਅਤੇ ਉੱਥੇ ਮੈਂ ਬੈਠੀ ਮੇਰੇ ਲਾਗ ਮੇਰੇ ਬੈਗ ਪਏ ਸੀ ਅਤੇ ਮੈਂ ਦੋ ਮਿੰਟ ਲਈ ਪਾਣੀ ਭਰਨ ਗਈ ਵਾਟਰ ਕੂਲਰ ਕੋਲੋਂ ਜੋ ਕੀ ਮੇਰੀ ਓ ਕੁਰਸੀ ਚੇਅਰ ਦੇ ਨਾਲ ਹੀ ਸੀ ਅਤੇ ਮੈਂ ਪਾਣੀ ਭਰ ਕੇ ਜਦੋਂ ਆਈ ਅਤੇ ਉਦੋਂ ਮੈਂ ਦੇਖਿਆ ਕੀ ਉਹ ਨਾ ਬੈਗਾਂ ਵਿੱਚੋਂ ਮੇਰਾ ਇੱਕ ਬੈਗ ਗਾਇਬ ਸੀ ਖੋ ਗਿਆ ਸੀ ਅਤੇ ਮੈਂ ਆਲੇ ਦੁਆਲੇ ਵਾਲੇ ਵਿਅਕਤੀਆਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਵੀ ਅਸੀਂ ਬੈਗ ਨਹੀਂ ਦੇਖਿਆ ਅਤੇ ਮੈਨੂੰ ਲੱਗਿਆ ਵੀ ਮੇਰਾ ਬੈਗ ਕਿਤੇ ਬੱਸ 'ਚ ਰਹਿ ਗਿਆ ਹੋਵੇ ਤਾਂ ਮੈਂ ਬੱਸ 'ਚ ਜਾਕੇ ਵੀ ਦੇਖਿਆ ਮੈਨੂੰ ਬੱਸ 'ਚ ਜਾਕੇ ਵੀ ਬੈਗ ਨਹੀ ਮਿਲਿਆ ਅਤੇ ਫਿਰ ਜਦੋਂ ਮੈਂ ਮੁੜ ਕੇ ਆਈ ਮੈਂ ਦੁਬਾਰਾ ਫਿਰ ਉਹਨਾਂ ਵਿਅਕਤੀਆਂ ਤੋਂ ਪੁੱਛਿਆ ਜੋ ਮੇਰੇ ਲਾਗ ਬੈਠੇ ਸੀ ਦੂਜੀਆਂ ਕੁਰਸੀਆਂ ਸੀ ਅਤੇ ਉਹ ਕਹਿੰਦੇ ਵੀ ਏਥੋਂ ਇੱਕ ਕੋਈ ਬੰਦਾ ਆਇਆ ਸੀ ਅਤੇ ਉਹ ਬੈਗ ਚੱਕ ਕੇ ਲੈ ਗਿਆ ਅਤੇ ਉਹ ਉਹਨਾਂ ਨੂੰ ਲੱਗਿਆ ਵੀ ਉਹ ਬੈਗ ਉਸ ਵਿਅਕਤੀ ਦਾ ਹੀ ਹੈ ਜਿਹਨੇ ਬੈਗ ਚੱਕਿਆ ਹੈ ਅਤੇ ਮੈਂ ਹੁਣ ਇਸ ਚੀਜ਼ ਦੀ ਕੰਪਲੇਂਟ ਲਿਖਾਣੀ ਹੈ ਕਿਵੇ ਮੇਰਾ ਬੈਗ ਹੈ ਜੋ ਉਹ ਚੋਰੀ ਹੋ ਗਿਆ ਅਤੇ ਛੇਤੀ ਤੋਂ ਛੇਤੀ ਮੇਰੇ ਬੈਗ ਦੀ ਜਾਂਚ ਪੜਤਾਲ ਕੀਤੀ ਜਾਵੇ ਠੀਕ ਹੈ ਜੀ ਜੀ ਮੇਰਾ ਬੈਗ ਕਾਲੇ ਰੰਗ ਦਾ ਸੀ ਇਹ ਟਰੂ ਟਰੋਲੀ ਬੈਗ ਸੀ ਜੀ ਹਾਂਜੀ ਕਾਲੇ ਰੰਗ ਹਾਂ ਹਾਂਜੀ ਉਹਦੇ ਵਿੱਚ ਮੇਰਾ ਪੰਜ ਹਜ਼ਾਰ ਰੁਪਈਆ ਸੀ ਅਤੇ ਉਹਦੇ 'ਚ ਮੇਰੇ ਬਹੁਤ ਸਾਰੇ ਕੀਮਤੀ ਡੌਕੂਮੈਂਟਸ ਵੀ ਸੀ ਜੋ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਚਾਹੀਦੇ ਸੀ ਟ੍ਰੈਵਲਿੰਗ ਕਰਦੇ ਸਮੇਂ ਜੀ ਮੈਂ ਮੋਹਾਲੀ ਰੇਲਵੇ ਸਟੇਸ਼ਨ 'ਤੇ ਹੀ ਗਈ ਸੀ ਹਾਂਜੀ ਠੀਕ ਹੈ ਜੀ ਓਕੇ